ਹਾਂਜੀ ਮੈਂ ਵੀ ਮੱਧ ਪੀੜ੍ਹੀ ਦਾ ਇੱਕ ਹਿੱਸਾ ਹਾਂ ਸਾਡੇ ਤੋਂ ਪਹਿਲੇ ਜਿਹੜੀ ਪੀੜ੍ਹੀ ਪੁਰਾਣੀ ਪੀੜ੍ਹੀ ਉਹ ਅਸੀਂ ਮੱਧ ਪੀੜ੍ਹੀ ਵਾਲੇ ਅਤੇ ਹੁਣ ਸਾਡੇ ਤੋਂ ਅੱਗੇ ਇੱਕ ਪੀੜ੍ਹੀ ਆ ਗਈ ਹੈ ਜਿਹਨੂੰ ਅਸੀਂ ਨੌਜਵਾਨ ਪੀੜ੍ਹੀ ਕਹਿੰਦੇ ਹਾਂ ਅਤੇ ਇਹਨਾਂ ਤਿੰਨਾਂ ਦੇ ਵਿੱਚ ਬਹੁਤ ਜ਼ਿਆਦਾ ਅੰਤਰ ਹੈ ਬਹੁਤ ਜ਼ਿਆਦਾ ਫ਼ਰਕ ਹੈ ਸ ਜਿਹੜੀ ਸਾਡੇ ਤੋਂ ਵੀ ਪੁਰਾਣੀ ਪੀੜ੍ਹੀ ਸੀਗੀ ਉਹ ਬਹੁਤ ਵਧੀਆ ਬਹੁਤ ਮਿਲਣਸਾਰ ਲੋਕ ਆਪਣੇ ਹੱਥੀਂ ਕੰਮ ਕਰਨ ਵਾਲੇ ਬਹੁਤ ਮਿਹਨਤੀ ਬਹੁਤ ਮਿਹਨਤੀ ਲੋਕ ਸੀ ਬਹੁਤ ਮਿਲਾਪੜੇ ਸੁਭਾਅ ਦੇ ਲੋਕ ਸੀ ਸਾਡੀ ਵਾਲੀ ਪੀੜ੍ਹੀ ਨੂੰ ਮੱਧ ਪੀੜ੍ਹੀ ਨੂੰ ਕਾਫ਼ੀ ਆਰਾਮਦਾਇਕ ਚੀਜ਼ਾਂ ਮਿਲ ਗਈਆਂ ਥੋੜ੍ਹਾ ਜਿਹਾ ਮਿਹਨਤ ਥੋੜ੍ਹੀ ਘੱਟ ਗਈ ਥੋੜ੍ਹਾ ਜਿਹਾ ਮਸ਼ੀਨਾਂ ਮਸ਼ੀਨੀ ਯੁੱਗ ਆ ਗਿਆ ਥੋੜ੍ਹਾ ਜਿਹਾ ਮਸ਼ੀਨੀ ਯੁੱਗ ਨੇ ਲੈ ਲਿਆ ਸਮਾਂ ਅਤੇ ਸਾਡੀ ਵੀ ਪੀੜ੍ਹੀ ਦਾ ਇੱਦਾਂ ਹੀ ਟਾਈਮ ਨਿਕਲਿਆ ਪਰ ਜਿਹੜੀ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਆ ਉਹ ਉਹਨਾਂ ਨੂੰ ਉਹ ਉਹ ਕੁਛ ਨਹੀਂ ਉਹਨਾਂ ਨੂੰ ਮਿਲਿਆ ਜੋ ਕਿ ਪੁਰਾਣੀ ਪੀੜ੍ਹੀ ਨੇ ਆਪਣੇ ਉੱਪਰ ਹੰਢਾਇਆ ਜਾਂ ਮੱਧ ਪੀੜ੍ਹੀ ਨੇ ਆਪਣੇ ਉੱਪਰ ਹੰਢਾਇਆ ਨੌਜਵਾਨ ਪੀੜ੍ਹੀ ਨੂੰ ਬਹੁਤ ਆਰਾਮਦਾਇਕ ਟਾਈਮ ਨਿਕਲ ਮਿਲ ਗਿਆ ਉਹਨਾਂ ਨੂੰ ਆਪਣਾ ਟੋਟਲ ਸਾਰਾ ਹੀ ਕੰਮ ਮਸ਼ੀਨਾਂ ਦੇ ਉੱਤੇ ਡਿਪੈਂਡ ਹੋ ਗਿਆ ਜਿਹੜੀ ਪੁਰਾਣੀ ਪੀੜ੍ਹੀ ਸੀ ਉਹ ਆਪਣੇ ਹੱਥੀਂ ਕੰਮ ਕਰਦੇ ਸੀ ਜਿਹੜੀਆਂ ਔਰਤਾਂ ਸੀ ਉਹ ਆਪਣੇ ਘਰ 'ਚ ਪੋਚਾ ਮਾਰਦੀਆਂ ਸੀ ਮਸਾਲੇ ਕੁੱਟਦੀਆਂ ਸੀ ਕਣਕ ਪੀਸਦੀਆਂ ਸੀ ਬੜੀ ਮਿਹਨਤ ਕਰਦੀਆਂ ਸੀ ਬੜੀ ਵਰਜਿਸ਼ ਹੁੰਦੀ ਸੀ ਉਹ ਉਹ ਟਾਈਮ ਨੂੰ ਅੱਜ ਕੱਲ੍ਹ ਦੀ ਪੀੜ੍ਹੀ ਨੇ ਇੱਕ ਜਿੰਮ ਨੂੰ ਦੇ ਦਿੱਤਾ ਕਿ ਜਾਈਏ ਆਪਣੀ ਐਕਸਰਸਾਈਜ਼ ਕਰੀਏ ਅਤੇ ਆਪਣੇ ਘਰ ਆ ਜਾਈਏ ਇਹਨਾਂ ਨੂੰ ਮਿਹਨਤ ਕਰਨ ਦੀ ਮਿਹਨਤ ਕਰਕੇ ਕਮਾਉਣ ਦੀ ਆਦਤ ਨਹੀਂ ਰਹੀ ਹਰ ਕੰਮ ਜਿਹੜਾ ਔਨਲਾਈਨ ਹੋ ਗਿਆ ਹਰ ਕੰਮ ਮਸ਼ੀਨਾਂ ਦੇ ਉੱਤੇ ਡਿਪੈਂਡ ਕਰਦਾ ਹਰ ਚੀਜ਼ ਲਈ ਮਸ਼ੀਨ ਦੇ ਉੱਤੇ ਡਿਪੈਂਡ ਕਰਦੇ ਇੱਥੋਂ ਤੱਕ ਕਿ ਔਰਤਾਂ ਅੱਜ ਕੱਲ੍ਹ ਸਬਜ਼ੀ ਕੱਟਣ ਲਈ ਵੀ ਮਸ਼ੀਨ ਦੀ ਹੀ ਵਰਤੋਂ ਕਰਨ ਲੱਗ ਪਈਆਂ ਹਨ ਇਹ ਇਹਨਾਂ ਦੇ ਵਿੱਚ ਇਹ ਸਭ ਤੋਂ ਵੱਡਾ ਅੰਤਰ ਆਇਆ ਹੈ ਜਿਸ ਕਰਕੇ ਅੱਜ ਪੁਰਾਣੀ ਪੀੜ੍ਹੀ ਦੇ ਲੋਕਾਂ ਨੂੰ ਕੋਈ ਬਿਮਾਰੀਆਂ ਨਹੀਂ ਸੀ ਹੁੰਦੀਆਂ ਕੁਛ ਨਹੀਂ ਸੀ ਹੁੰਦਾ ਉਹ ਆਪਣੀ ਵਰਜਿਸ਼ ਕਰਦੇ ਸੀ ਬੜੇ ਤੰਦਰੁਸਸਤ ਰਹਿੰਦੇ ਸੀ ਅਤੇ ਅੱਜ ਕੱਲ੍ਹ ਦੀ ਪੀੜ੍ਹੀ ਨੂੰ ਆਰਾਮਦਾਇਕ ਰਹਿਣ ਕਰਕੇ ਹੀ ਉਹਨਾਂ ਨੂੰ ਬਿਮਾਰੀਆਂ ਨੇ ਘੇਰ ਲਿਆ ਮੋਟਾਪੇ ਨੇ ਘੇਰ ਲਿਆ ਕੁਛ ਖਾਣ ਪੀਣ ਦਾ ਗ਼ਲਤ ਸੰਤੁਲਨ ਨੇ ਖ਼ਰਾਬ ਕਰ ਦਿੱਤਾ